ਤਿੰਨ ਜਨਵਰੀ ਦੋ ਹਜ਼ਾਰ ਪੰਜ ਸੱਤ ਫਰਵਰੀ ਦੋ ਹਜ਼ਾਰ ਪੰਜ ਚੌਵੀ ਜੂਨ ਉੱਨੀ ਸੌ ਪਚੱਤਰ ਅੱਠ ਮਾਰਚ ਉੱਨੀ ਸੌ ਅੱਸੀ ਉੱਨੀ ਅੋਕਟੂਬਰ ਦੋ ਹਜ਼ਾਰ ਸੱਤ